ਮੇਰੀ ਇੱਕ ਦਿਨ ਦੀ ਖੁਰਾਕ ਵਿੱਚ ਉਹ ਸਭ ਕੁਝ ਸ਼ਾਮਲ ਹੁੰਦਾ ਹੈ ਜੋ ਕਿ ਇੱਕ ਸੰਤੁਲਿਤ ਖੁਰਾਕ ਵਿੱਚ ਹੋਣਾ ਚਾਹੀਂਦਾ ਹੈ ਮੈਂ ਆਪਣੇ ਦਿਨ ਦੀ ਸ਼ੁਰੂਆਤ ਖਾਲੀ ਪੇਟ ਨਾਰੀਅਲ ਪਾਣੀ ਪੀ ਕੇ ਕਰਦਾ ਹਾਂ ਇਸ ਤੋਂ ਬਾਅਦ ਬ੍ਰੇਕਫਾਸਟ ਵਿੱਚ ਮੈਂ ਦਲੀਆ ਫ਼ਲ ਪੋਹਾ ਖਿਚੜੀ ਬਰੈੱਡ ਆਂਡੇ ਓਟਸ ਆਦਿ ਚੀਜ਼ਾਂ ਦਾ ਸੇਵਨ ਕਰਦਾ ਹਾਂ ਇਸ ਤੋਂ ਬਾਅਦ ਕੁਝ ਤਾਜ਼ੇ ਫ਼ਲਾਂ ਦਾ ਸੂਪ ਪੀਂਦਾ ਹਾਂ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਮੈਂ ਸਲਾਦ ਖਾਂਦਾ ਹਾਂ ਦੁਪਹਿਰ ਦੇ ਖਾਣੇ ਦੇ ਵਿੱਚ ਮੈਂ ਦਾਲ ਰੋਟੀ ਸਬਜ਼ੀ ਰੋਟੀ ਬ੍ਰਾਉਨ ਰਾਈਸ ਜਾਂ ਕੁਝ ਹੋਰ ਖਾਂਦਾ ਹਾਂ ਇਸ ਤੋਂ ਬਾਅਦ ਸ਼ਾਮ ਨੂੰ ਸੂਪ ਦਾ ਸੇਵਨ ਕਰਦਾ ਹਾਂ ਇੱਕ ਕੱਪ ਮੈਂ ਗ੍ਰੀਨ ਟੀ ਦਾ ਸੇਵਨ ਵੀ ਕਰਦਾ ਹਾਂ ਰਾਤ ਦੇ ਡਿਨਰ ਤੋਂ ਪਹਿਲਾਂ ਮੈਂ ਕੁਝ ਸਲਾਦ ਜਾਂ ਫ਼ਲ ਜ਼ਰੂਰ ਖਾਂਦਾ ਹਾਂ ਰਾਤ ਦਾ ਖਾਣਾ ਮੈਂ ਸੱਤ ਵਜੇ ਤੋਂ ਪਹਿਲਾਂ ਕਰ ਹਾਂ ਰਾਤ ਦੇ ਖਾਣੇ ਵਿੱਚ ਮੈਂ ਦਾਲ ਰੋਟੀ ਸਬਜ਼ੀ ਰੋਟੀ ਬ੍ਰਾਉਨ ਰਾਈਸ ਆਦਿ ਚੀਜ਼ਾਂ ਖਾਂਦਾ ਹਾਂ ਇੱਕ ਸੰਤੁਲਿਤ ਖੁਰਾਕ ਸਾਡੀ ਚੰਗੀ ਸਿਹਤ ਵਿੱਚ ਯੋਗਦਾਨ ਪਾਉਂਦੀ ਹੈ ਸੰਤੁਲਿਤ ਖੁਰਾਕ ਉਹ ਹੁੰਦੀ ਹੈ ਜਿਸ ਵਿੱਚ ਸਾਡੇ ਸਰੀਰ ਲਈ ਜ਼ਰੂਰੀ ਪ੍ਰੋਟੀਨ ਕਾਰਬੋਹਾਈਡ੍ਰੇਟ ਖਣਿਜ ਚਰਬੀ ਕੈਲਸ਼ੀਅਮ ਅਤੇ ਹੋਰ ਵਿਟਾਮਿਨਸ ਮੌਜੂਦ ਹੁੰਦੇ ਹਨ ਸੰਤੁਲਿਤ ਖੁਰਾਕ ਸਾਡੀ ਸਿਹਤ ਨੂੰ ਤੰਦਰੁਸਤ ਰੱਖਦੀ ਹੈ ਸੰਤੁਲਿਤ ਖੁਰਾਕ ਖਾਣ ਨਾਲ ਕੋਈ ਵੀ ਬਿਮਾਰੀ ਨੇੜੇ ਨਹੀਂ ਆਉਂਦੀ ਸੰਤੁਲਿਤ ਖੁਰਾਕ ਖਾਣ ਨਾਲ ਸਾਡੇ ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਅਤੇ ਸਾਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਰਹਿੰਦੀ ਸੰਤੁਲਿਤ ਖੁਰਾਕ ਨਾਲ ਸਾਡੀ ਉਮਰ ਲੰਬੀ ਹੁੰਦੀ ਹੈ ਅਤੇ ਅਸੀਂ ਹਰ ਸਮੇਂ ਜਵਾਨ ਦਿਖਾਈ ਦਿੰਦੇ ਹਾਂ ਸੰਤੁਲਿਤ ਖੁਰਾਕ ਨਾਲ ਸਾਡਾ ਸਰੀਰ ਰਿਸ਼ਟ ਪੁਸ਼ਟ ਰਹਿੰਦਾ ਹੈ ਭਾਰ ਨਹੀਂ ਵੱਧਦਾ ਅਤੇ ਚਿਹਰੇ 'ਤੇ ਗਲੋਅ ਰਹਿੰਦਾ ਹੈ ਅਤੇ ਕਿਸੇ ਵੀ ਕਿਸਮ ਦੀ ਸੁਸਤੀ ਜਾਂ ਆਲਸ ਨੇੜੇ ਨਹੀਂ ਆਉਂਦੀ ਹਾਂ ਮੈਨੂੰ ਆਪਣੀ ਖੁਰਾਕ ਵਿੱਚ ਸਬਜ਼ੀਆਂ ਚਾਵਲ ਅਤੇ ਹੋਰ ਚੰਗੀ ਕੁਆਲਟੀ ਦਾ ਅਨਾਜ ਮਿਲਦਾ ਹੈ ਮੈਂ ਆਪਣੀ ਕਮਾਈ ਦਾ ਜ਼ਰੂਰੀ ਹਿੱਸਾ ਸੰਤੁਲਿਤ ਖੁਰਾਕ ਜਿਵੇਂ ਕਿ ਚਾਵਲ ਫ਼ਲ ਸਬਜ਼ੀਆਂ ਫਰੂਟ ਡ੍ਰਾਈ ਫਰੂਟਸ ਦਹੀਂ ਓਟਸ ਮਿਨਰਲਸ ਇਨ੍ਹਾਂ ਚੀਜ਼ਾਂ 'ਤੇ ਖਰਚ ਕਰਦਾ ਹਾਂ